ਪੰਜਾਬ ਵਿੱਚ ਪ੍ਰਸਿੱਧ ਸ ਸੈਲਾਨੀ ਆਕਰਸ਼ਨਾਂ ਦੀ ਗੱਲ ਕਰੀਏ ਤਾਂ ਚਿੜੀਆ ਘਰ ਵਾਟਰ ਪਾਰਕ ਵਗੈਰਾ ਬਹੁਤ ਵਧੀਆ ਜਿਹੜੀਆਂ ਚੀਜ਼ਾਂ ਹੈ ਦੇਖਣ ਨੂੰ ਬਹੁਤ ਜ਼ਿਆਦਾ ਵਧੀਆ ਹੁੰਦੀਆਂ ਹਨ ਇਹਨਾਂ ਵਿੱਚ ਆਪਾਂ ਜਿਵੇਂ ਫਰੀ ਟਾਈਮ ਹੁੰਦਾ ਆ ਸਾਡਾ ਕੋਈ ਵੀ ਤਾਂ ਆਪਾਂ ਇੱਥੇ ਜਾ ਕੇ ਇੱਕ ਹਿਸਾਬ ਨਾਲ ਫੈਮਲੀ ਨਾਲ ਇੰਜੋਏ ਕਰ ਸਕਦੇ ਹਾਂ ਇੱਥੇ ਜਾ ਕੇ ਸਾਨੂੰ ਜਿੱਦਾਂ ਸਾਡੇ ਨਾਲ ਛੋਟੇ ਬੱਚੇ ਹੁੰਦੇ ਆ ਉਹਨਾਂ ਨੂੰ ਬਹੁਤ ਜ਼ਿਆਦਾ ਵਧੀਆ ਲੱਗਦਾ ਇੱਥੇ ਜਾ ਕੇ ਉਹ ਬਹੁਤ ਜ਼ਿਆਦਾ ਇੰਜੋਏ ਕਰਦੇ ਆ ਅਤੇ ਜਿਹੜੇ ਉੱਥੇ ਜਿਵੇਂ ਵਾਟਰ ਪਾਰਕ ਜਾ ਕੇ ਛੋਟੇ ਬੱਚੇ ਬਹੁਤ ਜ਼ਿਆਦਾ ਇੰਜੋਏ ਕਰਦੇ ਆ ਕਈ ਵੱਡੇ ਵੀ ਬਹੁਤ ਜ਼ਿਆਦਾ ਉੱਥੇ ਜਾ ਕੇ ਇੰਜੋਏ ਕਰਦੇ ਆ ਉੱਥੇ ਜਿਹੜੇ ਵਾਟਰ ਪਾਰਕ ਵਿੱਚ ਝੂਲੇ ਵਗੈਰਾ ਹੁੰਦੇ ਆ ਉਹਨਾਂ 'ਤੇ ਬੈਠ ਕੇ ਝੂਲੇ ਲੈ ਕੇ ਇੰਜੋਏ ਕਰਦੇ ਆ ਅਤੇ ਜੇ ਚਿੜੀਆਘਰ ਦੀ ਗੱਲ ਕਰੀਏ ਚਿੜੀਆਘਰ ਵਿੱਚ ਜਾ ਕੇ ਸਾਨੂੰ ਬਹੁਤ ਸਾਰੇ ਜਿਹੜੇ ਆ ਜਿਵੇਂ ਹੁਣ ਪਿੰਡਾਂ ਵਿੱਚ ਤਾਂ ਹੁੰਦੇ ਆ ਪੰਛੀਆਂ ਪੰਛੀ ਜਾਂ ਜਾਨਵਰ ਦੇਖਣ ਨੂੰ ਮਿਲਦੇ ਆ ਪਰ ਸ਼ਹਿਰਾਂ ਵਿੱਚ ਇਹੋ ਜਿਹੀਆਂ ਚੀਜ਼ਾਂ ਨਹੀਂ ਦੇਖਣ ਨੂੰ ਮਿਲਦੀਆਂ ਸ਼ਹਿਰਾਂ ਦੇ ਲੋਕ ਚਿੜਿਆਘਰ ਵਿੱਚ ਜਾ ਕੇ ਜ਼ਿਆਦਾ ਇੰਜੋਏ ਕਰਦੇ ਕਿਉਂਕਿ ਉਹਨਾਂ ਨੂੰ ਵੱਖਰੇ ਵੱਖਰੇ ਤਰ੍ਹਾਂ ਦੇ ਪੰਛੀ ਜਾਨਵਰ ਵਗੈਰਾ ਦੇਖਣ ਨੂੰ ਮਿਲਦੇ ਆ ਇਸ ਕਰਕੇ ਉਹ ਚਿੜੀਆਘਰ ਵਿੱਚ ਜਾ ਕੇ ਵਧੀਆ ਟਾਈਮ ਸਪੈਂਡ ਕਰਦੇ ਆ